ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਨੂੰ ਤੁਹਾਡਾ ਨੰਬਰ ਦਿੱਤਾ ਹੈ ਮੇਰੇ ਮਿੱਤਰ ਨੇ ਕਿ ਤੁਸੀਂ ਡਿਸਪੋਜਲ ਪਲੇਟਾਂ ਵਗੈਰਾ ਤੁਸੀਂ ਰੈਂਟ 'ਤੇ ਦਿੰਦੇ ਹੋ ਅਤੇ ਮੈਂ ਸਾਡੇ ਘਰ ਦਸ ਤਰੀਕ ਨੂੰ ਪ੍ਰੋਗਰਾਮ ਹੈਗਾ ਵਾ ਅਤੇ ਮੈਨੂੰ ਸੌ ਡਿਸਪੋਜਲ ਪਲੇਟਾਂ ਸੌ ਕਾਂਟੇ ਚਮਚ ਦੀ ਲੋੜ ਹੈਗੀ ਆ ਮੈਨੂੰ ਤੁਹਾਡਾ ਨਾਮ ਸੋ ਮੈਨੂੰ ਮੇਰੇ ਦੋਸਤ ਨੇ ਤੁਹਾਡੇ ਨਾਮ ਦੱਸਿਆ ਰੈਕਮੈਂਡ ਕੀਤਾ ਹੈਗਾ ਅਤੇ ਉਹ ਕਪੂਰਥਲੇ ਦੇ ਮੈਨੂੰ ਵੀ ਪਤਾ ਲੱਗਾ ਤੁਸੀਂ ਬਹੁਤ ਵਧੀਆ ਡਲੀਵਰਿੰਗ ਕਰਦੇ ਹੈਗੇ ਆ ਅਤੇ ਤੁਹਾਡੀ ਪਲੇਟ ਦੀ ਪਲੇਟ ਦੀ ਕੁਆਲਿਟੀ ਵਗੈਰਾ ਸਭ ਕੁਛ ਵਧੀਆ ਹੈਗੀ ਹੈ ਜੇ ਤੁਸੀਂ ਸਾਨੂੰ ਇਹ ਉਸ ਇਸ ਔਡਰ ਦਸ ਤਰੀਕ ਨੂੰ ਕਿਰਪਾ ਕਰਕੇ ਕਪੂਰਥਲਾ ਜਲੰਧਰ ਕਪੂਰਥਲਾ ਜੱਟਪੁਰਾ ਮੁਹੱਲੇ ਵਿੱਚ ਡਿਲੀਵਰ ਕਰ ਦਿਉ ਤਾਂ ਕਿ ਸਾਡਾ ਪ੍ਰੋਗਰਾਮ ਆਨੰਦਮਈ ਨਾਲ ਹੋ ਜੇ ਅਤੇ ਤੁਹਾਡੀ ਪੇਮੈਂਟ ਔਨ ਦਾ ਸਪੋਟ ਡਿਲੀਵਰੀ 'ਤੇ ਹੋ ਜੂਗੀ ਜੇ ਕੋਈ ਤੁਹਾਨੂੰ ਲ ਹੁਣ ਐਡਵਾਂਸ ਦੀ ਲੋੜ ਹੈਗੀ ਆ ਤਾਂ ਮੈਂ ਤੁਹਾਨੂੰ ਹੁਣ ਪੇਮੈਂਟ ਰਾਹੀਂ ਗੂਗਲ ਪੇਅ ਰਾਹੀਂ ਤੁਹਾਨੂੰ ਔਡਰ ਕ ਪੇਅ ਕਰ ਦਿੰਦਾ ਹੈਗਾ ਵਾ